ਪੰਜਾਬ ਵਿੱਚ ਬਹੁਤ ਪ੍ਰਸਿੱਧ ਸੈਲਾਨੀ ਆਕਰਸ਼ਣ ਹਨ ਜਿਹਨਾਂ ਨੂੰ ਦੇਖ ਕੇ ਲੋਕ ਬਹੁਤ ਵਧੀਆ ਮਹਿਸੂਸ ਕਰਦੇ ਹਨ ਅਤੇ ਇਹਨਾਂ ਨੂੰ ਦੇਖਣ ਲਈ ਲੋਕ ਬਾਹਰੋਂ ਵੀ ਆਉਂਦੇ ਹਨ ਜਿਵੇਂ ਕਿ ਪਟਿਆਲੇ ਵਿੱਚ ਸਥਿਤ ਮੋਤੀ ਬਾਗ ਪੈਲਸ ਹੈ ਜਿਸ ਵਿੱਚ ਬਹੁਤ ਸਾਰੀਆਂ ਦੇਖਣ ਅਤੇ ਆਕ ਆਕਰਸ਼ਿਤ ਕਰਨ ਵਾਲੀਆਂ ਵਾਲੀਆਂ ਹਨ ਇਹਨਾਂ ਲੋਕਾਂ ਦਾ ਇਕੱਠ ਭਰਿਆ ਹੀ ਰਹਿੰਦਾ ਹੈ ਸਾਰੇ ਪੰਜਾਬ ਵਿੱਚੋਂ ਇਹ ਵੀ ਇੱਕ ਬਹੁਤ ਮਸ਼ਹੂਰ ਜਗ੍ਹਾ ਹੈ ਇਸ ਤੋਂ ਬਾਅਦ ਸੰਨਸਿਟੀ ਅਮੂਸਮੈਂਟ ਪਾਰਕ ਜੋ ਕਿ ਅੰਮ੍ਰਿਤਸਰ ਵਿੱਚ ਹੈ ਉਹ ਵੀ ਬਹੁਤ ਵਧੀਆ ਦੇਖਣ ਲਈ ਦੇਖਣ ਯੋਗ ਸਥਾਨ ਹੈ ਪਟਿਆਲਾ ਵਿੱਚ ਇੱਕ ਹੋਰ ਖਾਸ ਜਗ੍ਹਾ ਹੈ ਜਿਸ ਨੂੰ ਕਿਲ੍ਹਾ ਮੁਬਾਰਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸ ਨੂੰ ਇੱਕ ਕਿਲ੍ਹੇ ਵਾਂਗ ਬਣਾਇਆ ਗਿਆ ਹੈ ਜਿਸ ਵਿੱਚ ਆ ਕੇ ਲੋਕ ਪੁਰਾਣੇ ਜਮਾਨੇ ਦੇ ਕਿਲ੍ਹੇ ਵਾਂਗ ਮਹਿਸੂਸ ਕਰਦੇ ਹਨ